ਸੁਰਾਂ ਦੀ ਗਹਿਰਾਈ ਨੂੰ ਵਧਾਉਣ ਲਈ ਬਹੁਤ ਕੁਛ ਕੀਤਾ ਜਾ ਸਕਦਾ ਹੈ ਪਹਿਲੇ ਤਾਂ ਸੁਰਾਂ ਦਾ ਰਿਆਜ਼ ਬਹੁਤ ਜ਼ਰੂਰੀ ਹੈ ਜਿਸ ਨੂੰ ਸੁਰਾਂ ਦਾ ਰਿਆਜ਼ ਹੈ ਉਹ ਹੀ ਗਾਏ ਗਾਇਕੀ ਗਾ ਸਕਦਾ ਹੈ ਅਤੇ ਗਾਇਕੀ ਨੂੰ ਇੰਪਰੂਵ ਕਰਨ ਲਈ ਆਪਣੀ ਗਾਇਕੀ ਨੂੰ ਸੁਧਾਰਨ ਲਈ ਤੁਹਾਨੂੰ ਪਹਿਲੇ ਜਿਹੜਾ ਗਾਣਾ ਹੈ ਉਹਦੇ ਸੁਰ ਉਹਦੇ ਬੋਲ ਸਮਝਣੇ ਹੋਣਗੇ ਉਹਦੇ ਵਿੱਚ ਰੁਝਣਾ ਪਵੇਗਾ ਤਾਂ ਜੋ ਉਸ ਗਾਣੇ ਦਾ ਰੂਪ ਨਿਕਲ ਕੇ ਆ ਸਕੇ ਪਹਿਲੇ ਉਸ ਗਾਣੇ ਦੀ ਸਿਚੁਏਸ਼ਨ ਸਮਝੋ ਉਸ ਗਾਣੇ ਦੀ ਵਰਡਿੰਗ ਸਮਝੋ ਫਿਰ ਉਸਨੂੰ ਆਪਣੇ ਅੰਦਰੋਂ ਜਿੰਨਾ ਚਿਰ ਨਹੀਂ ਗਾਓਗੇ ਸੁਰਾਂ ਦੇ ਵਿੱਚ ਉਹ ਸੁਧਾਰ ਨਹੀਂ ਆਵੇਗਾ ਇਸ ਲਈ ਕੋਈ ਖ਼ਾਸ ਰਿਆਜ਼ ਦੀ ਜ਼ਰੂਰਤ ਨਹੀਂ ਹੈ ਇਸ ਵਿੱਚ ਡੁੱਬਣ ਸੰਗੀਤ ਇੱਕ ਜਿਹੜੀ ਹੈ ਇੱਕ ਸਮੁੰਦਰ ਹੈ ਉਹਦੇ ਵਿੱਚ ਡੁੱਬ ਕੇ ਗਾਇਆ ਜਾਂਦਾ ਹੈ ਇਸ ਲਈ ਇਸ ਦੇ ਵਿੱਚ ਸਿਰਫ਼ ਰਿਆਜ਼ ਅਤੇ ਉਹਦੇ ਵਿੱਚ ਸਮਾਂ ਦੇਣ ਦੀ ਜ਼ਰੂਰਤ ਹੈ ਜਿੰਨਾ ਤੁਸੀਂ ਸੰਗੀਤ ਵਿੱਚ ਡੁੱਬ ਕੇ ਗਾਓਗੇ ਉੰਨਾ ਹੀ ਤੁਹਾਡੇ ਵਿੱਚ ਤੁਹਾਡੀ ਗਾਇਕੀ ਸੁਧਰੇਗੀ ਅਤੇ ਗਾਇਕੀ ਦੇ ਵਿੱਚ ਨਿਖਾਰ ਆਵੇਗਾ